ਜ਼ਿੰਦਗੀ ਵਿੱਚ ਕਲਾ ਦੀ ਬਹੁਤ ਵੱਡੀ ਅਹਿਮੀਅਤ ਹੈ ਸੰਸਾਰ ਵਿੱਚ ਬਹੁਤ ਸਾਰੀਆਂ ਕਲਾਵਾਂ ਹਨ ਜਿਵੇਂ ਨੱਚਣਾ ਵੀ ਇੱਕ ਕਲਾ ਹੈ ਗਾਉਣਾ ਵੀ ਇੱਕ ਕਲਾ ਹੈ ਖਾਣਾ ਪਕਾਉਣਾ ਵੀ ਇੱਕ ਕਲਾ ਹੈ ਪੇਂਟਿੰਗ ਵੀ ਇੱਕ ਕਲਾ ਹੈ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਪੇਂਟਿੰਗ ਜੋ ਆਪਾਂ ਕੱਪੜੇ 'ਤੇ ਵੀ ਕਰ ਸਕਦੇ ਹਾਂ ਕੱਪੜੇ 'ਤੇ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਕਰ ਸਕਦੇ ਹਾਂ ਜਦੋਂ ਅਸੀਂ ਕੱਪੜੇ ਤੇ ਪੇਂਟਿੰਗ ਕਰਕੇ ਬਾਜ਼ਾਰ ਵਿੱਚ ਵੇਚਦੇ ਹਾਂ ਤਾਂ ਇਸ ਤੋਂ ਸਾਨੂੰ ਬਹੁਤ ਸਾਰੀ ਆਮਦਨ ਹੁੰਦੀ ਹੈ ਇਹ ਵੀ ਇੱਕ ਆਮਦਨ ਦਾ ਸਾਧਨ ਹੈ ਹੋਰ ਅਸੀਂ ਪੇਂਟਿੰਗ ਕੰਧਾਂ 'ਤੇ ਵੀ ਕਰ ਸਕਦੇ ਹਾਂ ਅਸੀਂ ਗੁਰੂ ਸਾਹਿਬਾਨਾਂ ਦੇ ਚਿੱਤਰ ਬਣਾ ਕੇ ਇਹਨਾਂ ਨੂੰ ਬਾਜ਼ਾਰ ਵਿੱਚ ਵੇਚ ਸਕਦੇ ਹਾਂ ਇਹ ਵੀ ਇੱਕ ਆਮਦਨ ਦਾ ਬਹੁਤ ਵਧੀਆ ਸਾਧਨ ਹੈ